ਰੂਪਨਗਰ ਜ਼ਿਲ੍ਹੇ ਵਿੱਚ ਕੁਝ ਮਹੱਤਵਪੂਰਨ ਸਥਾਨ ਚਿੰਨ ਅਤੇ ਸੈਲਾਨੀ ਆਕਰਸ਼ਣ ਸਥਾਨ ਹਨ ਜਿਵੇਂ ਕਿ ਅਨੰਦਪੁਰ ਸਾਹਿਬ ਇੱਕ ਇਤਿਹਾਸਿਕ ਜਗ੍ਹਾ ਹੈ ਜਿੱਥੇ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਦੱਸਦੀ ਹੈ ਅਤੇ ਬਹੁਤ ਅੰਤਰਰਾਸ਼ਟਰੀ ਟੂਰਿਸਟ ਉੱਥੇ ਵਿਜ਼ਿਟ ਕਰਦੇ ਹਨ ਅਤੇ ਉੱਥੋਂ ਦਾ ਇਤਿਹਾਸ ਜਾ ਜਾਣਨ ਲਈ ਉੱਥੇ ਬਣੇ ਵਿਰਾਸਤ ਏ ਖਾਲਸਾ ਮਿਊਜ਼ੀਅਮ ਵਿੱਚ ਜਾਂਦੇ ਹਨ ਅਤੇ ਰੋਪੜ ਵਿੱਚ ਸਿੰਧੂ ਘਾਟੀ ਸੱਭਿਅਤਾ ਨੂੰ ਪ੍ਰਦਰਸ਼ਿਤ ਕਰਦੇ ਮਿਊਜ਼ੀਅਮ ਵੀ ਹਨ ਅਤੇ ਸਮਾਰਕ ਵੀ ਹਨ ਜਿਨ੍ਹਾਂ ਤੋਂ ਇਤਿਹਾਸ ਬਾਰੇ ਪਤਾ ਲੱਗਦਾ ਹੈ ਜੋ ਕਿ ਜੋ ਕਿ ਇਸ ਜ਼ਿਲ੍ਹੇ ਨੂੰ ਦਿਲਚਸਪ ਬਣਾਉਂਦੇ ਹਨ ਅਤੇ ਸੈਲਾਨੀਆਂ ਸੈਲਾਨੀਆਂ ਨੂੰ ਉੱਥੇ ਆਉਣ ਲਈ ਪ੍ਰੇਰਿਤ ਕਰਦੇ ਹਨ